ਸਾਡੇ ਇਲਾਕੇ ਦੇ ਵਿੱਚ ਰਿਫਾਇਨਰੀ ਹੈ ਤੇਲ ਸੋਧਕ ਕਾਰਖਾਨਾ ਜਿੱਥੇ ਬਹੁਤ ਸਾਰੇ ਵਰਕਰ ਕੰਮ ਕਰਦੇ ਹਨ ਜਿਹੜੇ ਚੰਗੀ ਤਨਖਾਹ ਲੈਂਦੇ ਹਨ ਆਪਣੇ ਪਰਿਵਾਰ ਦਾ ਚੰਗਾ ਜੀਵਨ ਰੁਜ਼ਗਾਰ ਚੰਗਾ ਜੀਵਨ ਜਿਉਂਦੇ ਨੇ ਚੰਗੀ ਰੁਜ਼ਗਾਰ ਰੁਜ਼ਗਾਰ ਦੇ ਮੌਕੇ ਉੱਤੇ ਵੱਧ ਤੋਂ ਵੱਧ ਮਿਲਦੇ ਨੇ ਲੋਕ ਸ ਸਮੇਂ ਸਿਰ ਕੰਮ ਦੇ ਜਾਂਦੇ ਨੇ ਕੰਮ 'ਤੇ ਆਉਂਦੇ ਨੇ ਚੰਗੇ ਰੁਜ਼ਗਾਰ ਨਾਲ ਉਹਨਾਂ ਦਾ ਜੀਵਨ ਪੱਧਰ ਉਪਰ ਚੱਕਿਆ ਗਿਆ ਗਾ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਰਿਫਾਇਨਰੀ ਦੇ ਵਿੱਚ ਕੰਮ ਮਿਲਿਆ ਗਾ ਰੁਜ਼ਗਾਰ ਦਾ ਤਾਂ ਉਹ ਰੁਜ਼ਗਾਰ ਨਾਲ ਉਹਨਾਂ ਦਾ ਆਮਦਨ ਦੇ ਵਿੱਚ ਵਾਧਾ ਹੋਇਆ ਗਾ ਜਿਸ ਕਾਰਨ ਉਹ ਆਪਦੀ ਪਰਿਵਾਰ ਦਾ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਕਰ ਰਹੇ ਹਨ